ਕੱਪੜੇ ਧੋਣ ਲਈ ਮੈਂ ਕੱਪੜੇ ਧੋਣ ਵਾਲੇ ਸਾਬਣ ਅਤੇ ਸਰਫ਼ ਦੀ ਵਰਤੋਂ ਕਰਦਾ ਹਾਂ ਇਹਨਾਂ ਨੂੰ ਸੁਕਾਉਣ ਲਈ ਮੈਂ ਜ਼ਿਆਦਾਤਰ ਇਹਨਾਂ ਨੂੰ ਬਾਹਰ ਖੁੱਲ੍ਹੇ ਵਾਤਾਵਰਨ ਵਿੱਚ ਧੁੱਪ ਵਿੱਚ ਸੁਕਾਉਂਦਾ ਹਾਂ ਬਟ ਪਰ ਜੇਕਰ ਮੈਨੂੰ ਬਹੁਤ ਜ਼ਿਆਦਾ ਕਾਹਲੀ ਹੋਵੇ ਤਾਂ ਮੈਂ ਇਸਨੂੰ ਕੱਪੜੇ ਸੁਕਾਉਣ ਵਾਲੀ ਮਸ਼ੀਨ ਵਿੱਚ ਸੁਕਾ ਲੈਂਦਾ ਹਾਂ ਕਈ ਵਾਰੀ ਬਰਸਾਤਾਂ ਦੇ ਮੌਸਮ ਵਿੱਚ ਮੈਂ ਇਹਨਾਂ ਨੂੰ ਆਪਣੇ ਘਰ ਦੀ ਛੱਤ ਦੇ ਹੇਠਾਂ ਵੀ ਸੁਕਾ ਲੈਂਦਾ ਹਾਂ